ਸਿਹਤ ਵਿੱਚ ਠੇਠ ਭਾਸ਼ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਸਿਹਤ ਸਾਡੀ ਪੁਸਤਕ ਲੋਕ ਠੇਠ ਪੰਜਾਬੀ ਵੀ ਜਾਣੀ ਜਾਂਦੀ ਹੈ ਉਹ ਸਮੇਂ ਸਾਡੀ ਭਾਸ਼ਾ ਵਿੱਚ ਕੋਈ ਰਲਾਵ ਨਹੀਂ ਸੀ ਜਿਵੇਂ ਸਾਡੀ ਪੁਰਾਣੀ ਭਾਸ਼ਾ ਵਿੱਚ ਸਾਡੇ ਗ੍ਰੰਥ ਆਦਿ ਲਿਖੇ ਹੋਏ ਸਨ ਇਸੇ ਪ੍ਰਕਾਰ ਸਾਡੇ ਕਵਿਤਾ ਵੀ ਭਾਸ਼ਾ ਵਾਲੇ ਸ਼ਬਦ ਵੀ ਵਰਤੋਂ ਕਰਦੇ ਹਨ ਸ਼ੁੱਧ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਕਲਾਵਾਂ ਕਲ ਵਰਤੀ ਜਾਂਦੀ ਹੈ ਸੱਭਿਆਚਾਰਕ ਤਰੀਕੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਤਸਵੀਰਾਂ ਰਾਹੀਂ ਅਸੀਂ ਪੰਜਾਬੀ ਭਾਸ਼ਾ ਬਾਰੇ ਦੱਸ ਸਕਦੇ ਹਾਂ ਹੋਰ ਸੱਭਿਆਚਾਰਕ ਕਲਾਵਾਂ ਜਿਵੇਂ ਲੋਕ ਨਾਚ ਜਾਂ ਲੋਕ ਗੀਤ ਵਿੱਚ ਵੀ ਵਰਤੀ ਜਾਂਦੀ ਹੈ ਸਾਡੇ ਪੁਰਾਣੇ ਸੱਭਿਆਚਾਰਕ ਸਾਨੂੰ ਗੀਤਾਂ ਵਿੱਚ ਵੀ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸੁਹਾਗ ਘੋੜੀਆਂ ਗੀਤ ਬੋਲੀਆਂ ਗਾਈਆਂ ਜਾਂਦੀਆਂ ਸਨ ਸਾਡੇ ਪੁਰਾਣੇ ਲੋਕ ਪਿਓਰ ਠੇਠ ਪੰਜਾਬੀ ਬੋਲਦੇ ਸਨ